ਕਰੋਨਾ ਮਹਾਂ ਮਾਰੀ ਦੇ ਆਉਣ ਨਾਲ ਬਹੁਤ ਸਾਰੇ ਕਾਰੋਬਾਰਾਂ ਵਿੱਚ ਬਦਲਾਵ ਆਇਆ ਜਿਸ ਨਾਲ ਕਈ ਲੋਕਾਂ ਦੀ ਜਾਨ ਵੀ ਚਲੀ ਗਈ ਅਤੇ ਕਰੋਨਾ ਮਹਾਂ ਮਾਰੀ ਦੇ ਆਉਣ ਨਾਲ ਕਈ ਲੋਕ ਕੰਮਾਂ 'ਤੇ ਜਾ ਨਹੀਂ ਪਾਉਂਦੇ ਸਨ ਅਤੇ ਉਨ੍ਹਾਂ ਦੇ ਕਾਰੋਬਾਰਾਂ ਵਿੱਚ ਹਾਨੀਆਂ ਹੀ ਹਾਨੀਆਂ ਹੋਈਆਂ ਅਤੇ ਉਨ੍ਹਾਂ ਨੂੰ ਨੁਕਸਾਨ ਹੋਇਆ ਕਾਰੋ ਕਰੋਨਾ ਮਹਾਮਾਰੀ ਦੇ ਕਈ ਲੋਕ ਬਾਹਰ ਘਰਾਂ ਤੋਂ ਬਾਹਰ ਨਹੀਂ ਨਿਕਲਦੇ ਸਨ ਕਰੋਨਾ ਮਹਾਮਾਰੀ ਤੋਂ ਡਰਦੇ ਮਾਰੇ ਉਹ ਕੰਮ 'ਤੇ ਨਹੀਂ ਜਾ ਪਾਉਂਦੇ ਸਨ ਜਿਸ ਨਾਲ ਉਨ੍ਹਾਂ ਦਾ ਕਾਰੋਬਾਰ ਬੰਦ ਹੋ ਗਿਆ ਅਤੇ ਉਨ੍ਹਾਂ ਨੂੰ ਬਹੁਤ ਸਾਰੀਆਂ ਹਾਨੀਆਂ ਹੋਈਆਂ ਅਤੇ ਉਨ੍ਹਾਂ ਨੂੰ ਬਹੁਤ ਸਾਰੀਆਂ ਤਕਲੀਫ਼ਾਂ ਦਾ ਸਾਮ੍ਹਣਾ ਕਰਨਾ ਪਿਆ ਜਿਸ ਨਾਲ ਓ ਜਿਸ ਨਾਲ ਕਈ ਲੋਕਾਂ ਦੀ ਕਰੋਨਾ ਮਹਾਂ ਮਾਰੀ ਵਿੱਚ ਜਾਨ ਵੀ ਚਲੀ ਗਈ ਇਸ ਲਈ ਕਰੋਨਾ ਮਹਾਂ ਮਾਰੀ ਵਿੱਚ ਕਾਰੋਬਾਰ ਬੰਦ ਰਿਹਾ ਅਤੇ ਲੋਕ ਅਤੇ ਲੋਕ ਲੋਕਾਂ ਨੂੰ ਖਾਣ ਪੀਣ ਲਈ ਕੁਛ ਨਹੀਂ ਮਿਲਦਾ ਸੀ